ਹੈਲੋ ਹਾਂਜੀ ਰਾਜੇ ਮੈਂ ਕੰਪਿਊਟਰ ਸੈਂਟਰ ਤੋਂ ਬੋਲ ਰਿਹਾ ਅੱਛਾ ਜੀ ਰਾਜੇ ਤੁਸੀਂ ਜਦੋਂ ਤੁਸੀਂ ਉਹਨੂੰ ਫਾਈਲ ਨੂੰ ਨਾ ਉਹ ਕਰਦੇ ਹੋ ਜਦੋਂ ਡਾਟਾ ਫਿਲ ਕਰ ਦਿੰਦੇ ਹੋ ਉਹਨੂੰ ਜਦੋਂ ਸੇਵ ਕਰਦੇ ਹੋ ਉਹਨੂੰ ਜਾਂ ਉਹ ਤੁਸੀਂ ਦੇਖਿਆ ਸੀ ਕਿਹੜੀ ਐਕਸਟੈਂਸ਼ਨ ਦੇ ਨਾਲ ਸੇਵ ਹੋਈ ਆ ਐਕਸਟੈਂਸ਼ਨ ਦੇ ਨਾਲ ਸੇਵ ਕਰਨੀ ਹੁੰਦੀ ਹੈ ਡੋਟ ਐਕਸ ਐਲ ਐਸ ਉਹ ਐਕਸਟੈਂਸ਼ਨ ਦੇ ਨਾਲ ਸੇਵ ਕਰ ਦਿਉ ਅਤੇ ਦੁਬਾਰਾ ਉਹਨੂੰ ਖੋਲ੍ਹ ਕੇ ਦੇਖਿਓ ਉਹ ਖੁੱਲ੍ਹ ਜੂਗੀ

ਹਾਂਜੀ ਹਾਂਜੀ ਮੈਨੂੰ ਤਾਂ ਜੀ ਦੋ ਤਰੀਕੇ ਨਾਲ ਲਿਆ ਜਾ ਲਿਆ ਲਿ ਲਗਾਇਆ ਜਾ ਸਕਦਾ ਇੱਕ ਸਮ ਫੰਕਸ਼ਨ ਯੂਜ ਕਰਕੇ ਅਤੇ ਅਤੇ ਇੱਕ ਬਿਨਾ ਸਮ ਫੰਕਸ਼ਨ ਯੂਜ ਕੀਤੇ ਜਿਵੇਂ ਤੁਸੀਂ ਸਮ ਫੰਕਸ਼ਨ ਯੂਜ਼ ਕਰਕੇ ਲਾਉਣਾ ਤੁਸੀਂ ਲਾਉਣਾ ਮੰਨ ਲਉ ਏ ਵਨ ਤੋਂ ਲੈ ਕੇ ਏ ਟੈਂਨ ਤੱਕ ਲਾਉਣਾ ਤਾਂ ਈ ਤੁਸੀਂ ਕਿਵੇਂ ਲਾਉਣਾ ਈਜ਼ ਈਕਲ ਟੂ ਦਾ ਸਾਈਨ ਐੱਸ ਯੂ ਐੱਮ ਬਰੈਕਟ ਸ਼ੁਰੂ ਏ ਵੰਨ ਤੋਂ ਲੈ ਕੇ ਏ ਵੰਨ ਕਾਲਨ ਏ ਟੈਂਨ ਬਰੈਕਟ ਬੰਦ ਐਂਟਰ ਪ੍ਰੈਸ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਕੋਲ ਉਹਦਾ ਆਨਸਰ ਆ ਜੂਗਾ ਇੱਕ ਤਾਂ ਤਰੀਕਾ ਇਹ ਹੁੰਦਾ ਦੂਸਰਾ ਤਰੀਕਾ ਕੀ ਹੁੰਦਾ ਤੁਸੀਂ ਬਿਨਾ ਸਮ ਫੰਕਸ਼ਨ ਤੋਂ ਲਾਉਣ ਦਾ ਜੇ ਮੰਨ ਲਉ ਤੁਸੀਂ ਏ ਵੰਨ ਤੋਂ ਲੈ ਕੇ ਏ ਫਾਈਵ ਤੱਕ ਲਾਉਣਾ ਤਾਂ ਤੁਸੀਂ ਫਿਰ ਕੀ ਲਿਖਣਾ ਪਊਗਾ ਇਕੁਅਲ ਟੂ ਦਾ ਸਾਈਨ ਏ ਵੰਨ ਪਲੱਸ ਏ ਟੂ ਪਲਸ ਏ ਥਰੀ ਪਲੱਸ ਏ ਫੋਰ ਪਲੱਸ ਏ ਫਾਈਵ ਫਿਰ ਤੁਸੀਂ ਐਂਟਰ ਕਰ ਦਿਉ ਤਾਂ ਤੁਹਾਡਾ ਸਮ ਦਾ ਅਨਸਰ ਆਜੂ ਆਪਦਾ ਜੇ ਤੁਸੀਂ ਜਦੋਂ ਸਾਰਾ ਕੰਮ ਆਪਦਾ ਉਹ ਕੀ ਕਰ ਲਿਆ ਕੰਮ ਕਰ ਲਿਆ ਉੱਦੂ ਬਾਅਦ ਉਹਨੂੰ ਸੇਵ ਕਰ ਦਿਉ ਸੇਵ ਕਰਨ ਤੋਂ ਬਾਅਦ ਤੁਸੀਂ ਫਾਈਲ ਨੂੰ ਕਿੱਥੇ ਸੇ ਉਸ ਤੋਂ ਬਾਅਦ ਕੀ ਕਰੋ ਤੁਸੀਂ ਫੇਰ ਗੂਗਲ ਕਰੋਮ ਖੋਲ੍ਹ ਲਉ ਗੂਗਲ ਕਰੋਮ ਦੇ ਵਿੱਚ ਜਾ ਕੇ ਉੱਥੇ ਭਰ ਦਿਉ ਐਕਸਲ ਟੂ ਪੀ ਡੀ ਐਫ ਕੰਪਿਊਟਰ ਆਨਲਾਈਨ ਤਾਂ ਤੁਸੀਂ ਐਕਸਲ ਟੂ ਪੀ ਡੀ ਐਫ ਕੰਪਿਊਟਰ ਆਨਲਾਈਨ ਭਰ ਦੋਗੇ ਤੁਹਾਡੇ ਕੋਲ ਵੈਬਸਾਈਟ ਉਹਨਾਂ 'ਚ ਕੋਈ ਵੀ ਇੱਕ ਵੈਬਸਾਈਟ ਨੂੰ ਖੋਲ੍ਹ ਕੇ ਤੁਸੀਂ ਆਪਦੀ ਫਾਈਲ ਨੂੰ ਸਿਲੈਕਟ ਕਰ ਲਉ ਫਾਈਲ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਉੱਥੇ ਨੀਚੇ ਬਟਨ ਹੋਊਗਾ ਕਨਵਰਟ ਦਾ ਤਾਂ ਤੁਹਾਡੀ ਉਹ ਫਾਈਲ ਜਿਹੜੀ ਹੋਊਗੀ ਐਕਸਲ ਤੋਂ ਪੀ ਡੀ ਐਫ ਦੇ ਵਿੱਚ ਕਨਵਰਟ ਹੋ ਜੂਗੀ ਕੁਝ ਹੀ ਸਕਿੰਟਾਂ ਦੇ ਵਿੱਚ ਹੀ ਉਸ ਤੋਂ ਬਾਅਦ ਉਹਨੂੰ ਤੁਸੀਂ ਡਾਊਨਲੋਡ ਕਰ ਲਓ ਡਾਊਨਲੋਡ ਜਦੋਂ ਕਰੋਗੇ ਤਾਂ ਤੁਸੀਂ ਉਹਨੂੰ ਦੇਖ ਲਓ ਤੁਸੀਂ ਕਿੱਥੇ ਡਾਊਨਲੋਡ ਕੀਤਾ ਜਿੱਥੇ ਤੁਸੀਂ ਡਾਊਨਲੋਡ ਕੀਤਾ ਬਾਅਦ ਵਿੱਚ ਉਹਨੂੰ ਉੱਥੋਂ ਜਾ ਕੇ ਓਪਨ ਕਰ ਲਓ ਹਾਂ ਰਾਜੇ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਿਓ ਮੈਂ ਹਾਜ਼ਰ ਹੋਊਗਾ ਓਕੇ